ਭਾਰਤੀ ਮੀਡੀਆ ਦੀ ਜੇ ਗੱਲ ਕਰਾਂ ਤਾਂ ਕੁਛ ਕੁ ਆਪਣੀਆਂ ਨਿਊਜ਼ ਜਿਹੜੇ ਹੈ ਉਹ ਗਲਤ ਦਿਖਾਉਂਦੇ ਹਨ ਜ਼ਿਆਦਾਤਰ ਤਾਂ ਪੁਰਾਣੀਆਂ ਨਿਊਜ਼ਾਂ ਚੱਕ ਕੇ ਦਿਖਾਉਂਦੇ ਰਹਿੰਦੇ ਹਨ ਜੋ ਕਿ ਲੋਕਾਂ ਦਾ ਬਹੁਤ ਜ਼ਿਆਦਾ ਪਾਗਲ ਬਣਾਉਂਦੇ ਹੈ ਉਸ ਤੋਂ ਬਾਅਦ ਜ਼ਿਆਦਾਤਰ ਇਹ ਰਾਜਨੀਤੀ ਵਿੱਚ ਵੜ੍ਹੇ ਰਹਿੰਦੇ ਹਨ ਉਸ ਤੋਂ ਇਲਾਵਾ ਗੱਲ ਕਰਾਂ ਇਹਨਾਂ ਦੀਆਂ ਜਿਹੜੀ ਖਬਰਾਂ ਹਨ ਉਹ ਢੁੱਕਵੀਆਂ ਨਹੀਂ ਹੁੰਦੀਆਂ ਜ਼ਿਆਦਤਰ ਤਾਂ ਇਹ ਸਹੀ ਤੱਥ ਨਹੀਂ ਦਿਖਾਉਦੀਆਂ ਅਤੇ ਇਹ ਮਤਲਬ ਇਹ ਇੱਕ ਤਰੀਕੇ ਦਾ ਬੰਦੇ ਨੂੰ ਪਾਗਲ ਹੀ ਬਣਾਉਂਦੇ ਹੋਰ ਕੋਈ ਗੱਲ ਨਹੀਂ ਹੈ ਕਈ ਵਾਰੀ ਦਿਖਾਉਂਦੇ ਵੀ ਹੈ ਸੱਚ ਵੀ ਦਿਖਾਉਂਦੇ ਕਈ ਵਾਰੀ ਪਰ ਜ਼ਿਆਦਾਤਰ ਤਾਂ ਨਾ ਇਹਨਾਂ ਦਾ ਨਾ ਝੂਠ ਹੀ ਹੁੰਦਾ ਹੈ ਉਸ ਤੋਂ ਬਾਅਦ ਗੱਲ ਕਰਾਂ ਅਖ਼ਬਾਰ ਦੀ ਤਾਂ ਜੱਗ ਬਾਣੀ ਅਖ਼ਬਾਰ ਜਿਹੜਾ ਹੈ ਸਭ ਤੋਂ ਵਧੀਆ ਹੈ ਉਸਦੇ ਵਿੱਚ ਵੀ ਜ਼ਿਆਦਾਤਰ ਅੱਜ ਤੱਕ ਕਦੇ ਇੱਦਾਂ ਸੁਣਨ ਨੂੰ ਨਹੀਂ ਮਿਲਿਆ ਵੀ ਹਾਂ ਗਲਤ ਹੈ ਪਰ ਕਦੇ ਕਦਾਰ ਵਿੱਚ ਨੂੰ ਹੋ ਜਾਂਦਾ ਹੈ ਪਰ ਜ਼ਿਆਦਾਤਰ ਤਾਂ ਜੱਗ ਬਾਣੀ ਅਖ਼ਬਾਰ ਵਿੱਚ ਜਿੰਨੀਆਂ ਵੀ ਖਬਰਾਂ ਆਉਦੀਆਂ ਸਾਰੀਆਂ ਸੱਚੀਆਂ ਹੁੰਦੀਆਂ ਹਨ ਨਿਊਜ਼ ਚੈਨਲਾਂ ਬਾਰੇ ਗੱਲ ਕਰਾਂ ਤਾਂ ਇਹ ਵੀ ਆਪਣੀ ਟੀ ਆਰ ਪੀ ਵਧਾਉਣ ਵਾਸਤੇ ਲੱਗੇ ਰਹਿੰਦੇ ਹਨ ਜ਼ਿਆਦਾਤਰ ਤਾਂ ਐਕਟਰਾਂ ਨੂੰ ਪਰਮੋਟ ਕਰਦੇ ਹਨ ਇਹ ਨਹੀਂ ਕਿ ਕਦੇ ਕਿਸੇ ਆਮ ਆਦਮੀ ਬਾਰੇ ਵੀ ਦੱਸਿਆ ਜਾਵੇ ਅਤੇ ਉਹਨਾਂ ਨੂੰ ਪਰਮੋਟ ਕੀਤਾ ਜਾਵੇ ਜ਼ਿਆਦਾਤਰ ਤਾਂ ਇੱਧਰ ਉੱਧਰ ਭੱਜਦੇ ਰਹਿੰਦੇ ਹਨ ਸਿਰਫ਼ ਟੀ ਆਰ ਪੀ ਵਧਾਉਣ ਵਾਸਤੇ ਇੱਕ ਇੱਕ ਨਿਊਜ਼ ਨੂੰ ਵਾਰ ਵਾਰ ਦਿਖਾਉਦੇ ਰਹਿੰਦੇ ਹਨ ਜਿਸ ਨਾਲ ਬੰਦਾ ਬੋਰ ਹੋ ਜਾਂਦਾ ਹੈ